ਸਵੇਰ ਦੇ ਸਮੇਂ ਖਾਲੀ ਪੇਟ ਮੈਂ ਦੋ ਗਿਲਾਸ ਪਾਣੀ ਪੀਂਦੀ ਹਾਂ ਪਾਣੀ ਪੀ ਕੇ ਦਸ ਮਿਨਟ ਬੈਠ ਕੇ ਮੈਂ ਫਿਰ ਜੋਗਿੰਗ ਕਰਨ ਜਾਂਦੀ ਹਾਂ ਜੋਗਿੰਗ ਕਰਕੇ ਆ ਕੇ ਫਿਰ ਮੈਂ ਪੰਜ ਮਿਨਟ ਬੈਠ ਕੇ ਫਿਰ ਮੈਂ ਦੋ ਗਿਲਾਸ ਪਾਣੀ ਪੀ ਕੇ ਫੇਰ ਮੈਂ ਆਪਣੀ ਰੂਟੀਨ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹਾਂ ਅੱਠ ਤੋਂ ਬਾਰ੍ਹਾਂ ਗਿਲਾਸ ਮੈਂ ਸਾਰੇ ਦਿਨ ਵਿੱਚ ਪਾਣੀ ਪੀਂਦੀ ਹਾਂ ਮੈਂ ਆਪਣੇ ਖਾਣੇ ਵਿੱਚ ਸਵੇਰੇ ਜੂਸ ਅਤੇ ਬ੍ਰੈਡ ਲੈਂਦੀ ਹਾਂ ਘੱਟ ਤੋਂ ਘੱਟ ਮੈਂ ਖਾਣਾ ਖਾਂਦੀ ਹਾਂ ਮੈਂ ਦੁਪਹਿਰ ਦੇ ਸਮੇਂ ਖਾਣਾ ਖਾਂਦੀ ਹਾਂ ਉਦੋਂ ਮੈਂ ਚਬਾ ਚਬਾ ਕੇ ਖਾਣਾ ਖਾਂਦੀ ਹਾਂ ਅਤੇ ਮੈਂ ਆਪਣੀ ਦਵਾਈ ਨੂੰ ਵੀ ਠੰਡੇ ਪਾਣੀ ਨਾਲ ਨਹੀਂ ਲੈਂਦੀ ਉਹ ਵੀ ਮੈਂ ਨਿੱਘੇ ਪਾਣੀ ਨਾਲ ਲੈਂਦੀ ਹਾਂ ਖਾਣਾ ਖਾਂਦੇ ਸਮੇਂ ਮੈਂ ਖਾਣਾ ਖਾਂਦੇ ਸਮੇਂ ਮੈਂ ਪਾਣੀ ਨਹੀਂ ਪੀਂਦੀ ਮੈਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ ਵਿੱਚ ਪਾਣੀ ਪੀਂਦੀ ਹਾਂ ਖਾਣੇ ਦੇ ਵਿੱਚ ਮੈਂ ਨਮਕ ਦੀ ਵਰਤੋਂ ਬਹੁਤ ਘੱਟ ਕਰਦੀ ਹਾਂ ਅਤੇ ਸਵੇਰ ਦੇ ਖਾਣੇ ਤੋਂ ਬਾਅਦ ਵਿੱਚ ਮੈਂ ਜਦ ਦੁਪਹਿਰੇ ਖਾਣਾ ਖਾਂਦੀ ਹਾਂ ਉਸ ਟਾਈਮ ਮੈਂ ਸੌਂਫ ਅਤੇ ਗੁੜ ਖਾਂਦੀ ਹਾਂ ਨਾਲ ਰਾਤ ਨੂੰ ਵੀ ਮੈਂ ਸੌਂਫ ਅਤੇ ਗੁੜ ਖਾਂਦੀ ਹਾਂ ਦੁਪਹਿਰ ਦੇ ਸਮੇਂ ਮੈਂ ਦਹੀਂ ਦੀ ਵਰਤੋਂ ਕਰਦੀ ਹਾਂ ਆਪਦੇ ਖਾਣੇ ਦੇ ਵਿੱਚ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਪਪੀਤਾ ਜ਼ਰੂਰ ਖਾਂਦੀ ਹਾਂ ਜਿਸ ਨਾਲ ਮੈਨੂੰ ਕਬਜ਼ ਦੀ ਕੋਈ ਪ੍ਰੋਬਲਮ ਨਾ ਰਹੇ ਅਤੇ ਮੈਂ ਆਪਣਾ ਸਾਰਾ ਭੋਜਨ ਚਬਾ ਚਬਾ ਕੇ ਹੌਲੀ ਹੌਲੀ ਖਾਂਦੀ ਹਾਂ ਰਾਤ ਦੇ ਸਮੇਂ ਮੈਂ ਆਪਦੇ ਕੋਲ ਮੋਬਾਇਲ ਦੀ ਵਰਤੋਂ ਬਹੁਤ ਘੱਟ ਕਰਦੀ ਹਾਂ ਨਾਸ਼ਤੇ ਤੋਂ ਪਹਿਲਾਂ ਔਰ ਰਾਤ ਦੇ ਖਾਣੇ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਚੱਲਣਾ ਪਸੰਦ ਕਰਦੀ ਹਾਂ ਰਾਤ ਦੇ ਸਮੇਂ ਮੈਂ ਦਹੀਂ ਚਾਵਲ ਰਾਜਮਾਂਹ ਨਹੀਂ ਖਾਂਦੀ ਅਤੇ ਮੈਂ ਫਰਿਜ ਦਾ ਠੰਡਾ ਠੰਡਾ ਪਾਣੀ ਵੀ ਨਹੀਂ ਪੀਂਦੀ